ਮੈਂ ਆਪਣੇ ਕਿਰਦਾਰਾਂ ਦਾ ਵਿਕਾਸ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ

ਭਰੋਸੇਯੋਗ ਅਤੇ ਦਿਲਚਸਪ ਅੱਖਰ ਬਣਾਉਣ ਲਈ ਕੋਈ ਖ਼ਾਸ ਪ੍ਰਕਿਰਿਆ ਤਾਂ ਨਹੀਂ ਹੈ ਪਰ ਮੇਰੇ ਆਸ ਪਾਸ ਜੋ ਵੀ ਪ੍ਰਕਿਰਿਆ ਹੁੰਦੀ ਹੈ ਉਸਨੂੰ ਨੋਟਿਸ ਕਰਦੇ ਹੋਏ ਮੈਂ ਕਿਰਦਾਰਾਂ ਦਾ ਲਿਖਣਾ ਸ਼ੁਰੂ ਕਰ ਦਿੰਦਾ ਹਾਂ ਮੈਂ ਜਦੋਂ ਵੀ ਕਿਰਦਾਰਾਂ ਉੱਤੇ ਕੋਈ ਕਹਾਣੀ ਜਾਂ ਲੇਖ ਲਿਖਣਾ ਹੁੰਦਾ ਹੈ ਤਾਂ ਮੈਂ ਬਿਲਕੁਲ ਇੱਕ ਸ਼ਾਂਤ ਵਾਤਾਵਰਨ ਤੇ ਭਾਲ ਕਰਦਾ ਹਾਂ ਮੈਂ ਕਿਸੇ ਵੀ ਸਮਾਜ ਜਾਂ ਮਨੁੱਖ ਨੂੰ ਉਸ ਦੇ ਅਪ ਉਸ ਬਾਰੇ ਅਪਮਾਨਜਨਕ ਗੱਲਾਂ ਨਹੀਂ ਕਰਦਾ ਕਿਉਂਕਿ ਮਨੁੱਖ ਅਤੇ ਸਮਾਜ ਦੇ ਅਪਮਾਨਜਨਕ ਗੱਲਾਂ ਕਰਨੀਆਂ ਸਹੀ ਨਹੀਂ ਹੁੰਦੀਆਂ ਸਮਾਜ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ ਬਹੁਤ ਸਾਰੀ ਪ੍ਰਕਿਰਿਆ ਹੁੰਦੀ ਹੈ ਅਤੇ ਇਸਨੂੰ ਕਰਨ ਲਈ ਸਮਾਜ ਅਤੇ ਮਨੁੱਖ ਨੂੰ ਨੋਟਿਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ